ਕਾਰਵਾਈ ਅਨੁਮਾਨਿਤ ਡਲਿਵਰੀ ਸਮੇਂ ਨੂੰ ਪੁੱਛੋ ਦ੍ਰਿਸ਼ ਤੁਸੀਂ ਭੋਜਨ ਦਾ ਔਡਰ ਕੀਤਾ ਹੈ ਅਤੇ ਇਹ ਜਾਨਣਾ ਚਾਹੁੰਦੇ ਹੋ ਕਿ ਇਹ ਤੁਹਾਨੂੰ ਕਦੋਂ ਡਲੀਵਰ ਕੀਤਾ ਜਾਵੇਗਾ ਤੁਸੀਂ ਪਤੇ ਦਾ ਜ਼ਿਕਰ ਕਰਦੇ ਹੋਏ ਰੈਸਟੋਰੈਂਟ ਜਾਂ ਫੂਡ ਔਡਰਿੰਗ ਐਪ ਨੂੰ ਅੰਦਾਜ਼ਨ ਡਲੀਵਰੀ ਸਮੇਂ ਲਈ ਪੁੱਛ ਸਕਦੇ ਹੋ